ਹੈਲੋ ਨਮਸਕਾਰ ਸਰ ਹਾਂਜੀ ਸਰ ਮੈਂ ਪੰਕਜ ਗੱਲ ਕਰ ਰਿਹਾ ਸੀਗਾ ਫਾਜਿਲਕਾ ਤੋਂ ਹਾਂਜੀ ਸਰ ਮੈਂ ਨਾ ਆਪਦਾ ਪਾਸਪੋਰਟ ਅਪਲਾਈ ਕੀਤਾ ਸੀਗਾ ਮੈਂ ਨਾ ਐਚੂਅਲੀ ਕੈਨੇਡਾ ਜਾਣਾ ਸੀਗਾ ਤੇ ਉਧਰ ਦਾ ਵੀਜ਼ਾ ਚਾਹੀਦਾ ਸੀਗਾ ਤੇ ਉਸ ਲਈ ਨਾ ਮੈਂ ਪਾਸਪੋਰਟ ਅਪਲਾਈ ਕੀਤਾ ਸੀ ਤੇ ਮੇਰੇ ਬੈਡ ਵਗੈਰਾ ਤਾਂ ਆ ਗਏ ਆ ਤੇ ਉਹਨਾਂ ਨੇ ਕਿਹਾ ਪਹਿਲਾਂ ਪਾਸਪੋਰਟ ਬਣਾ ਲਓ ਤੇ ਮੈਂ ਇਹ ਪੁੱਛਣਾ ਕਰਨਾ ਸੀਗਾ ਹਾਂਜੀ ਹਾਂਜੀ ਮੈਂ ਇਹ ਪਤਾ ਕਰਨਾ ਸੀਗਾ ਵੀ ਪੰਜਾਬ ਦੇ ਵਿੱਚ ਪਾਸਪੋਰਟ ਜਿਹੜੇ ਸੇਵਾ ਕੇਂਦਰ ਅਪਲਾਈ ਕਰਨ ਵਾਸਤੇ ਕਿਹੜੇ ਕਿਹੜੇ ਸ਼ਹਿਰ ਹੈਗੇ ਆ ਜੀ ਕਿਧਰ ਕਿਧਰ ਜਾ ਸਕਦੇ ਆਂ ਕਿਉਂਕਿ ਮੈਨੂੰ ਨਾ ਦੋ ਮਹੀਨਿਆਂ ਬਾਅਦ ਮੈਂ ਮਤਲਬ ਮੇਰਾ ਉਹ ਕਲੀਅਰ ਹੋ ਗਿਆ ਵੀ ਮੈਂ ਦੋ ਮਹੀਨਿਆਂ ਬਾਅਦ ਜੋ ਇਨਟੇਕ ਹੈਗੀ ਆ ਉਹਦੀ ਕੈਨੇਡਾ ਦੀ ਤੇ ਉਹਦੇ ਵਿੱਚ ਜਾਣਾ ਤਾਂ ਮੈਂ ਤਾਂ ਕਰਕੇ ਪੁੱਛ ਰਿਹਾ ਸੀ ਵੀ ਕਿਹੜਾ ਕਿਹੜਾ ਉਹ ਹੈਗੇ ਆ ਸੈਂਟਰ ਵਗੈਰਾ ਜਾਂ ਪਾਸਪੋਰਟ ਕੇਂਦਰ ਕਿਹੜੇ ਕਿਹੜੇ ਹੈਗੇ ਸਰ ਹਾਂਜੀ ਹਾਂਜੀ ਸਰ ਮੈਂ ਪੰਜਾਬ ਫਾਜਿਲਕਾ ਤੋਂ ਗੱਲ ਕਰ ਰਿਹਾ ਫਾਜ਼ਿਲਕਾ ਤੋਂ ਗੱਲ ਹਾਂਜੀ ਹਾਂਜੀ ਸਰ ਠੀਕ ਆ ਸਰ ਠੀਕ ਐ ਸਰ ਅੱਛਾ ਅੰਮ੍ਰਿਤਸਰ ਇਸ ਤੋਂ ਇਲਾਵਾ ਸਰ ਠੀਕ ਆ ਸਰ ਸਰ ਵੇਟਿੰਗ ਕਿੰਨੀ ਆ ਰਹੀ ਐ ਫਿਰੋਜਪੁਰ ਦੀ ਤੇ ਅੰਮ੍ਰਿਤਸਰ ਦੀ ਸਰ ਸਰ ਅੰਮ੍ਰਿਤਸਰ ਦੀ ਠੀਕ ਐ ਤੇ ਸਰ ਇਹ ਮਤਲਬ ਜਿਵੇਂ ਆਪਾਂ ਅਪਲਾਈ ਕੀਤਾ ਤੇ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਹਾਡੇ ਇਧਰ ਜਾਣਾ ਪੈਂਦਾ ਅਪਲਾਈ ਉਧਰ ਉਹ ਸੂਵਿਧਾ ਦਾ ਕੇਂਦਰ ਜਿਹੜਾ ਪਾਸਪੋਰਟ ਹੁੰਦਾ ਇਹਦੇ ਕਿੰਨੀ ਦੇਰ ਤੱਕ ਆਣਾ ਜਾਣਾ ਪੈਂਦਾ ਮਤਲਬ ਅਪਲਾਈ ਕਰਨ ਤੋਂ ਬਾਅਦ ਕਿ ਡੇਟ ਵਗੈਰਾ ਆਉਂਦੀ ਐ ਮੇਲ ਸਾਨੂੰ ਮੇਲ ਆਏਗਾ ਮੈਸੇਜ ਆਏਗਾ ਸਰ ਠੀਕ ਐ ਸਰ ਠੀਕ ਐ ਸਰ ਠੀਕ ਠੀਕ ਆ ਸਰ ਠੀਕ ਐ ਸਰ ਸਰ ਅਸੀਂ ਦੱਸ ਰਹੇ ਅਸੀਂ ਤਾਂ ਫਰੀ ਹੈਗੇ ਆ ਜੀ ਸਾਨੂੰ ਤਾਂ ਕੱਲ ਬੁਲਾ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਸਾਨੂੰ ਤਾਂ ਉਹ ਕੋਈ ਦਿੱਕਤ ਨਹੀਂ ਅੱਛਾ ਅੱਛਾ ਤੇ ਡਾਕੂਮੈਂਟ ਸਰ ਫਿਰ ਕਿਹੜੀ ਕਿਹੜੀ ਲੈ ਕੇ ਆਣੇ ਹੁੰਦੇ ਸਰ ਉੱਥੇ ਡਾਕੂਮੈਂਟਸ ਵਗੈਰਾ ਕਿਹੜੇ ਲੈ ਕੇ ਆਣੇ ਪੈਣੇ ਠੀਕ ਐ ਸਰ ਠੀਕ ਹੈ ਸਰ ਠੀਕ ਐ ਸਰ ਤੇ ਬਾਕੀ ਉਸ ਤੋਂ ਬਾਅਦ ਸਰ ਉਸ ਤੋਂ ਬਾਅਦ ਮਤਲਬ ਨਾਲ ਨਾਲ ਮਤਲਬ ਜਦੋਂ ਸਾਰਾ ਉਥੇ ਸੁਵਿਧਾ ਕੇਂਦਰ ਹੋ ਗਿਆ ਉਸ ਤੋਂ ਬਾਅਦ ਪਾਸਪੋਰਟ ਮਤਲਬ ਕਿੰਨੇ ਦਿਨਾਂ ਬਾਅਦ ਆ ਜਾਂਦਾ ਸਰ ਠੀਕ ਐ ਠੀਕ ਐ ਸਰ ਚਲੋ ਸਰ ਫਿਰ ਮਤਲਬ ਮੈਂ ਹੁਣ ਫਿਰ ਪਾਸਪੋਰਟ ਕੇਂਦਰ ਫਿਰੋਜਪੁਰ ਅੰਮ੍ਰਿਤਸਰ ਵਾਸਤੇ ਅਪਲਾਈ ਕਰ ਦੇਣਾ ਜੇ ਕੋਈ ਹੋਰ ਦਿੱਕਤ ਆਈ ਤਾਂ ਮੈਂ ਤੁਹਾਨੂੰ ਕਾਲ ਕਰਕੇ ਪੁੱਛ ਲਾਂਗਾ ਸਰ ਹਾਂ ਹਾਂਜੀ ਹਾਂਜੀ ਠੀਕ ਐ ਸਰ ਠੀਕ ਐ ਥੈਂਕਯੂ ਸਰ